ਪੁਰਾਣੇ ਸਮੇਂ ਤੋਂ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਚੁੱਲ੍ਹੇ ਵਾਲੇ ਜਾਂਦੇ ਸਨ ਪਰ ਉਹਨਾਂ ਦੇ ਨਾਲ ਧੂੰਆਂ ਵਗੈਰਾ ਹੁੰਦਾ ਜਿਹਦੇ ਨਾਲ ਟੀਬੀ ਹੋਰ ਕਈ ਕਿਸਮ ਦੀਆਂ ਬਿਮਾਰੀਆਂ ਹੋ ਜਾਂਦੀਆਂ ਸਨ ਇਸ ਕਰਕੇ ਹੁਣ ਹੌਲੀ ਹੌਲੀ ਲੋਕ ਐੱਲ ਪੀ ਜੀ ਗੈਸ ਵੱਲ ਨੂੰ ਹੋ ਗਏ ਪਰ ਗੈਸ ਇੰਨਾ ਮਹਿੰਗਾ ਹੈ ਕਿ ਆਮ ਬੰਦੇ ਦੇ ਭਰਾਉਣ ਵਾਸਤੇ ਬੜੀ ਮੁਸ਼ਕਿਲ ਹੈ ਅਤੇ ਮੁਸ਼ਕਿਲ ਦੇ ਨਾਲ ਜੇ ਗੈਸ ਸਿਲੰਡਰ ਜਿਹੜਾ ਆਪਾਂ ਲੈ ਵੀ ਲਈਏ ਤਾਂ ਇਹਨੂੰ ਕਈ ਸਾਵਧਾਨੀਆਂ ਵੀ ਵਰਤਣ ਦੀ ਲੋੜ ਪੈਂਦੀ ਹੈ ਇਹਦੇ ਵਿੱਚ ਗੰਧਕ ਗੈਸ ਹੁੰਦੀ ਹੈ ਕਈ ਵਾਰੀ ਸਿਲੰਡਰ ਜਦੋਂ ਘੱਟ ਉਟਾਇਆ ਜਾਂਦਾ ਹੈ ਤਾਂ ਕਈ ਲੋਕ ਇਹਨੂੰ ਟੇਢਾ ਕਰਕੇ ਵਰਤਣ ਦੀ ਕੋਸ਼ਿਸ਼ ਕਰਦੇ ਹਨ ਜਿਹਦੇ ਨਾਲ ਗੰਧਕ ਗੈਸ ਨਾਲੀ ਵਗੈਰਾ ਵਿੱਚ ਆ ਜਾਂਦੀ ਹੈ ਨਾਲੀ ਵੀ ਕਈ ਵਾਰੀ ਜੇ ਲੀਕ ਹੋਣ ਦਾ ਆਪਾਂ ਨੂੰ ਡਰ ਹੈ ਤਾਂ ਛੇਤੀ ਛੇਤੀ ਵਟਾਉਣੀ ਚਾਹੀਦੀ ਹੈ ਤਾਂ ਕਿ ਕਿਤੇ ਸ਼ਾਟ ਸਾਰਕਟ ਵੈਸੇ ਕਿਤੇ ਅੱਗ ਨਾ ਲੱਗ ਸਕੇ ਚੁੱਲ੍ਹੇ ਨੂੰ ਵਰਤਦੇ ਸਮੇਂ ਸਾਵਧਾਨੀਆਂ ਜ਼ਰੂਰ ਰੱਖੋ ਜਦ ਜਦ ਵੀ ਖਾਣਾ ਬਣਾਉਣਾ ਤ ਤੋਂ ਬਾਅਦ ਚੁੱਲ੍ਹੇ ਦੇ ਜਿਹੜੇ ਗੈਸ ਆ ਉਹਨੂੰ ਧਿਆਨ ਨਾਲ ਬੰਦ ਕਰੋ ਅਤੇ ਰੋਜ਼ ਰਾਤ ਨੂੰ ਰਾਤ ਨੂੰ ਕੱਲ੍ਹ ਕੂ ਰੈਗੂਲੇਟਰ ਤੋਂ ਗੈਸ ਨੂੰ ਧਿਆਨ ਨਾਲ ਬੰਦ ਕਰੋ ਤਾਂ ਕਿ ਅਸੀਂ ਇਸਦੀ ਕਿਸੇ ਦੁਰਘਟਨਾ ਤੋਂ ਬਚ ਸਕੀਏ